ਪੰਛੀ ਇੱਕ ਇਦਾਂ ਦੀ ਚੀਜ਼ ਹੈ ਕਿ ਜਿਹੜਾ ਇੱਕ ਜਗਹਾ ਤੇ ਟਿੱਕ ਕੇ ਨਹੀਂ ਰਹਿ ਸਕਦਾ ਹੈ ਪੰਛੀ ਤਾਂ ਆਪਣੇ ਆਪ ਵਿੱਚ ਹੈ ਕਿ ਉਡਦਾ ਪਰਿੰਦਾ ਇੱਕ ਮਨੁੱਖ ਵੀ ਇੱਕ ਉਡਿੰਤਾ ਪਰਿੰਦਾ ਬਣਨਾ ਚਾਹੁੰਦਾ ਹੈ ਕਿ ਉਹ ਵੀ ਇੱਕ ਕਹਿੰਦਾ ਹੈ ਕਿ ਮੈਂ ਵੀ ਪੰਛੀ ਵੱਕਣ ਘੁੰਮਾ ਫਿਰਾ ਬਾਕੀ ਪੰਛੀਆਂ ਵਿੱਚੋਂ ਪੰਛੀ ਜਿਹੜਾ ਕਬੂਤਰ ਵਗੈਰਾ ਹੈ ਉਹ ਤੁਹਾਨੂੰ ਅੱਜ ਕੱਲ ਸ਼ਹਿਰਾਂ ਵਿੱਚ ਆਮ ਦੇਖਣ ਨੂੰ ਮਿਲ ਜਾਣਗੇ ਹਰ ਜਗਹਾ ਤੇ ਤੁਸੀਂ ਦੇਖੋਗੇ ਕਬੂਤਰ ਇਦਾਂ ਦਾ ਹੈ ਕਿ ਉਹ ਤੁਸੀਂ ਸ਼ਹਿਰਾਂ ਵਿੱਚ ਲੋਕੀ ਇਹਨਾਂ ਨੂੰ ਰੋਟੀ ਜਾਂ ਜੌਂ ਵਗੈਰਾ ਜਾਂ ਸਤਨਾਜਾ ਵਗੈਰਾ ਪਾਉਂਦੇ ਹਨ ਜਗ੍ਹਾ ਜਗ੍ਹਾ ਤੇ ਤੁਸੀਂ ਦੇਖਿਆ ਹੋਏਗਾ ਉਹ ਕਿਤੇ ਵੀ ਇੱਕ ਜਗਹਾ ਬਣੀ ਹੁੰਦੀ ਲੋਕੀ ਉਥੇ ਜਾ ਕੇ ਪਾਂਦੇ ਹਨ ਤੇ ਪਛੀ ਉੱਥੇ ਇਕੱਠੇ ਹੋ ਕੇ ਕਬੂਤਰ ਆਉਂਦੇ ਆਉਂਦੇ ਖੁਸ਼ ਹੁੰਦੇ ਹਨ ਤੇ ਉਹ ਖਾਂਦੇ ਵੀ ਹਨ ਤੇ ਇਹਨਾਂ ਦੀ ਤੇ ਥਾਂ ਤੇ ਕਬੂਤਰਾਂ ਦੀ ਹੁਣ ਬਹੁਤ ਜਿਆਦਾ ਹੋ ਗਈ ਹੋਈ ਹ ਸ਼ਹਿਰਾਂ ਵਿੱਚ ਬਾਕੀ ਇਹਨਾਂ ਦੇ ਆਲਣੇ ਆ ਜਿੱਥੋਂ ਮਰਜ਼ੀ ਕੋਈ ਤਿਨਕਾ ਕੋਈ ਝਾੜੂ ਦਾ ਤੀਲਾ ਕੁਛ ਵੀ ਲੈ ਕੇ ਸਾਡੇ ਘਰਾਂ ਵਿੱਚ ਹੀ ਇਥੇ ਕਿਤੇ ਬਣਾ ਲੈਂਦੇ ਹਨ ਇਹਨਾਂ ਨੂੰ ਜਗ੍ਹਾ ਲੱਭਦੀ ਹੈ ਤੇ ਉਥੇ ਹੀ ਐਹ ਰਹਿੰਦੇ ਹਨ ਤੇ ਉਥੇ ਉਹ ਕਾਫੀ ਸਮੇਂ ਵਿੱਚ ਆਲਣਾ ਬਣਾਉਂਦੇ ਹਨ ਜੇ ਅਸੀਂ ਉਹਨਾਂ ਦੇ ਆਲਿਆਂ ਨੂੰ ਨਾ ਛੇੜੀਏ ਤਾਂ ਫਿਰ ਉਥੇ ਹੀ ਆਂਡੇ ਵੀ ਦੇ ਦਿੰਦੇ ਹਨ ਤੇ ਬਾਕੀ ਚਿੜੀਆ ਕਾਂ ਅੱਜ ਕੱਲ ਚਿੜੀਆ ਵਗੈਰਾ ਤੁਹਾਨੂੰ ਥੋੜੇ ਬਹੁਤੇ ਦੇਖਣ ਨੂੰ ਸ਼ੈਦ ਕਾਂ ਜਿਹੜੇ ਹੁਣ ਨਹੀਂ ਦਿਖਦੇ ਕਿਉਂਕਿ ਅੱਜ ਕੱਲ ਸ਼ਹਿਰਾਂ ਵਿੱਚ ਇੰਟਰਨੈਟ ਦੇ ਟਾਵਰ ਵਗੈਰਾ ਬਹੁਤ ਜਿਆਦਾ ਹੋ ਗਏ ਹਨ ਤੇ ਇਸ ਕਰਕੇ ਉਹ ਸਾਰੀਆਂ ਚੀਜਾਂ ਕਰਕੇ ਐਹ ਹੁਣ ਨਹੀਂ ਦਿਖਦੇ ਉਹ ਬਾਕੀ ਪੰਛੀ ਜਿਆਦਾ ਜੰਗਲਾਂ ਵਿੱਚ ਹੀ ਦਿਖਦੇ ਹਨ ਤੇ ਬਾਕੀ ਬਸ ਇਨਾ ਹੀ ਕਹਿਣਾ ਚਾਹਵਾਂਗੀ ਧੰਨਵਾਦ